ਸਾਡੀ ਸਥਾਨਿਕ ਭਾਸ਼ਾ ਵਿੱਚ ਬਹੁਤ ਸਾਰੇ ਯੂਟੀਊਬ ਚੈਨਲ ਅਤੇ ਟੀ ਵੀ ਪ੍ਰੋਗਰਾਮ ਹਨ ਜਿਹਨਾਂ ਨੂੰ ਮੈਂ ਦੇਖਣਾ ਪਸੰਦ ਕਰਦੀ ਹਾਂ ਅੱਜ ਕੱਲ੍ਹ ਦੇ ਸਮੇਂ ਵਿੱਚ ਬਹੁਤ ਸਾਰੇ ਪੰਜਾਬੀ ਚੈਨਲਸ ਅਤੇ ਟੀ ਵੀ ਪ੍ਰੋਗਰਾਮ ਆਉਂਦੇ ਹਨ ਜੋ ਕਿ ਸਾਰੇ ਹੀ ਪੰਜਾਬੀ ਲੋਕ ਬਹੁਤ ਹੀ ਦੇਖਣਾ ਪਸੰਦ ਕਰਦੇ ਹਨ ਗੱਲ ਕੀਤੀ ਜਾਵੇ ਤਾਂ ਖ਼ਬਰਾਂ ਦੇ ਚੈਨਲਾਂ ਦੀ ਯੂਟੀਊਬ 'ਤੇ ਅਤੇ ਟੀ ਵੀ ਪ੍ਰੋਗਰਾਮਾਂ 'ਤੇ ਹੀ ਮਿਲ ਜਾਂਦੇ ਹਨ ਜਿਵੇਂ ਕਿ ਪ੍ਰੋ ਪੰਜਾਬ ਟੀ ਵੀ ਐਸ ਐਮ ਟੀ ਵੀ ਟੀ ਵੀ ਪੀ ਟੀ ਸੀ ਨਿਊਜ਼ ਪੀ ਟੀ ਸੀ ਪੰਜਾਬ ਜੀ ਨਿਊਜ਼ ਜੀ ਪੰਜਾਬੀ ਚੜਦੀ ਕਲਾ ਟਾਈਮ ਟੀ ਵੀ ਇੱਥੇ ਹੀ ਹਰ ਰੋਜ਼ ਹੀ ਖ਼ਬਰਾਂ ਦਾ ਸਿਲਸਿਲਾ ਚਾਲੂ ਰਹਿੰਦਾ ਹੈ ਲੋਕ ਬਹੁਤ ਸਾਰੇ ਲੋਕ ਜਿਹੜਾ ਕਿ ਨਿਊਜ਼ਾਂ ਨੂੰ ਦੇਖਣਾ ਪਸੰਦ ਕਰਦੇ ਹਨ ਅਤੇ ਮੈਂ ਵੀ ਇਹਨਾਂ ਚੈਨਲਾਂ 'ਤੇ ਹਰ ਇੱਕ ਨਿਊਜ਼ ਨੂੰ ਦੇਖਦੀ ਹਾਂ ਅਤੇ ਮੈਨੂੰ ਹਰ ਇੱਕ ਸਮੇਂ ਦੀ ਨਿਊਜ਼ ਮਿਲ ਜਾਂਦੀ ਹੈ ਜੇ ਗੱਲ ਕੀਤੀ ਜਾਵੇ ਪੰਜਾਬੀ ਫਿਲਮਾਂ ਦੀ ਤਾਂ ਉਹ ਪਿਟਾਰਾ ਟੀ ਵੀ ਅਤੇ ਪੀ ਟੀ ਸੀ ਗੋਲਡ ਜੋ ਕਿ ਮੇਨ ਚੈਨਲ ਹਨ ਜਿਨ੍ਹਾਂ 'ਤੇ ਹਰ ਰੋਜ਼ ਹੀ ਪੰਜਾਬੀ ਫਿਲਮਾਂ ਦੇਖਣ ਨੂੰ ਮਿਲਦੀਆਂ ਹਨ ਇਸ ਤੋਂ ਇਲਾਵਾ ਹੋਰ ਭਾਸ਼ਾਵਾਂ ਦੀ ਗੱਲ ਕੀਤੀ ਜਾਵੇ ਤਾਂ ਮੈਂ ਹਿੰਦੀ ਚੈਨਲਾਂ ਨੂੰ ਦੇਖਣਾ ਪਸੰਦ ਕਰਦੀ ਹਾਂ ਜਿਵੇਂ ਕਿ ਖ਼ਬਰਾਂ ਦੀ ਗੱਲ ਕੀਤੀ ਜਾਵੇ ਆਜ ਤੱਕ ਜੀ ਨਿਊਜ਼ ਏ ਬੀ ਪੀ ਨਿਊਜ਼ ਨਿਊਜ਼ ਟਵੈਂਟੀ ਫੋਰ ਇੱਥੇ ਵੀ ਹਿੰਦੀ ਵਿੱਚ ਨਿਊਜ਼ਾਂ ਆਉਂਦੀਆਂ ਹਨ ਜੋ ਕਿ ਸਾਰੇ ਹੀ ਵਰਲਡ ਨੂੰ ਕਵਰ ਕਰਦੀਆਂ ਹਨ ਜੇ ਗੱਲ ਕੀਤੀ ਜਾਵੇ ਹਿੰਦੀ ਫਿਲਮਾਂ ਦੀ ਤਾਂ ਉਹਨਾਂ ਦੇ ਵੀ ਆਪਣੇ ਵੱਖਰੇ ਚੈਨਲ ਹਨ ਜਿਵੇਂ ਕਿ ਗੋਲਡਮਾਨਸ ਸਟਾਰ ਵਿਸਟਾ ਸਟਾਰ ਗੋਲਡ ਸਟਾਰ ਪਲੱਸ ਸਟਾਰ ਸਪੋਰਟਸ ਹਨ ਜਿਨ੍ਹਾਂ 'ਤੇ ਰੋਜ਼ ਹੀ ਵੱਖਰੇ ਵੱਖਰੇ ਤਰ੍ਹਾਂ ਦੇ ਪ੍ਰੋਗਰਾਮ ਚੱਲਦੇ ਹਨ ਜੇ ਗੱਲ ਕੀਤੀ ਜਾਵੇ ਅੰਗਰੇਜ਼ੀ ਚੈਨਲਸ ਦੀ ਤਾਂ ਟੀ ਵੀ ਪ੍ਰੋਗਰਾਮ 'ਤੇ ਡਿਸਕਵਰੀ ਚੈਨਲ ਚੱਲਦਾ ਹੈ ਜਿੱਥੇ ਬਹੁਤ ਹੀ ਤਰ੍ਹਾਂ ਤਰ੍ਹਾਂ ਦੇ ਜਾਨਵਰ ਅਤੇ ਜੰਗਲਾਂ ਦੀ ਸੈਰ ਕਰਵਾਈ ਜਾਂਦੀ ਹੈ ਜੋ ਕਿ ਮੈਂ ਪ੍ਰੋਗਰਾਮ ਦੇਖਣਾ ਬਹੁਤ ਹੀ ਪਸੰਦ ਕਰਦੀ ਹਾਂ ਇਹ ਕੁਝ ਕੁ ਮੇਰੇ ਟੀ ਵੀ ਪ੍ਰੋਗਰਾਮ ਅਤੇ ਯੂਟੀਊਬ ਚੈਨਲਸ ਹਨ ਜਿੰਨਾਂ ਨੂੰ ਮੈਂ ਦੇਖਣਾ ਪਸੰਦ ਕਰਦੀ ਹਾਂ